ਸਤਿ ਸ਼੍ਰੀ ਅਕਾਲ ਸਰ ਮੈਂ ਨਿਸ਼ਾ ਮੈਂ ਕਰਿਆਮ ਰੋਡ ਤੋਂ ਬੋਲ ਰਹੀ ਹਾਂ ਮੇਰੀ ਇੱਕ ਹਾਊਸ ਨੰਬਰ ਹੈਗਾ ਆ ਨੱਬੇ ਅਤੇ ਇਹ ਨੇੜੇ ਪੈਂਦਾ ਹੈਗਾ ਕੇਸੀ ਕੋਲਜ ਦੇ ਮੈਂ ਰਾਤ ਨੂੰ ਫਲਾਈਟ ਲੈਣੀ ਹੈਗੀ ਆ ਚੰਡੀਗੜ੍ਹ ਤੋਂ ਦਿੱਲੀ ਦੀ ਅਤੇ ਮੈਨੂੰ ਰਾਤ ਦੇ ਦਿੱਲੀ ਪਹੁੰ ਸੋਰੀ ਚੰਡੀਗੜ੍ਹ ਪਹੁੰਚਣ ਦੇ ਲਈ ਮੈਨੂੰ ਇੱਕ ਟੈਕਸੀ ਚਾਹੀਦੀ ਹੈਗੀ ਆ ਅਤੇ ਜੇ ਤੁਹਾਡੇ ਕੋਲ ਕੋਈ ਟੈਕਸੀ ਹੈਗੀ ਆ ਤਾਂ ਮੈਨੂੰ ਪਲੀਸ ਕੋਂਟੈਕਟ ਕਰੋ ਅਤੇ ਟੈਕਸੀਜ਼ ਦੇ ਸਾਰੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਅਤੇ ਜੋ ਵੀ ਤੁਸੀਂ ਟੈਕਸੀ ਡਰਾਈਵਰ ਸਾਨੂੰ ਭੇਜੋਂਗੇ ਉਹਦੇ ਕੋਲ ਪੂਰੇ ਡਾਕੂਮੈਂਟਸ ਹੋਣੇ ਚਾਹੀਦੇ ਆ ਅਤੇ ਉਹਨੇ ਕੋਈ ਵੀ ਨਸ਼ਾ ਨਹੀਂ ਕੀਤਾ ਹੋਣਾ ਚਾਹੀਦਾ ਹੈਗਾ ਏ ਆ ਅਤੇ ਇਸਦੇ ਰਿਲੇਟਡ ਜੇ ਤੁਹਾਡੇ ਕੋਲ ਹੋਰ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਤਾਂ ਉਹ ਵੀ ਮੈਨੂੰ ਪਲੀਸ ਸ਼ੇਅਰ ਕਰਿਓ ਅਤੇ ਜੇ ਤੁਹਾਨੂੰ ਜਦ ਹੋਰ ਕੋਈ ਵੀ ਉਸਦੇ ਨਾਲ ਮਤਲਬ ਕਿ ਜਾਂ ਕੋਈ ਬੱਸ ਜਾਂ ਕੋਈ ਔਟੋ ਜਾਂ ਫਿਰ ਕੋਈ ਹੋਰ ਸੁਵਿਧਾ ਹੈਗੀ ਆ ਤਾਂ ਉਹਦੇ ਬਾਰੇ ਵੀ ਮੈਨੂੰ ਦੱਸ ਦਿਓ ਅਤੇ ਇਸਦੇ ਰਿਲੇਟਡ ਜੇ ਮਤਲਬ ਕਿ ਜੋ ਕੋਈ ਹੋਰ ਵੀ ਡਾਕੂਮੈਂਟਸ ਜਿਹੜੇ ਕਿ ਮੈਂ ਆਪਣੇ ਨਾਲ ਲੈ ਕੇ ਆਉਣੇ ਹੈਗੇ ਆ ਜਾਂ ਫਿਰ ਟੈਕਸੀ ਦੇ ਵਿੱਚ ਬੈਠਣ ਦੇ ਲਈ ਜਾਂ ਤੁਹਾਡੀ ਕੋਈ ਹੋਰ ਇੰਸਟਰਕਸ਼ਨਸ ਹੈਗੀਆਂ ਤਾਂ ਤੁਸੀਂ ਮੈਨੂੰ ਉਹ ਵੀ ਦੱਸ ਸਕਦੇ ਹੈਗੇ ਆ ਅਤੇ ਮੈਨੂੰ ਜਲਦੀ ਤੋਂ ਜਲਦੀ ਕਨੈਕਟ ਕਰਿਓ ਕਿਉਂਕਿ ਮੈਂ ਰਾਤ ਨੂੰ ਸਫਰ ਕਰਨਾ ਹੈਗਾ ਅਤੇ ਉਸ ਤੋਂ ਪਹਿਲਾਂ ਹੀ ਮੈਨੂੰ ਇੱਕ ਟੈਕਸੀ ਚਾਹੀਦੀ ਹੈਗੀ ਆ ਜਿਹਦੇ ਵਿੱਚ ਮੈਂ ਮਤਲਬ ਕਿ ਚੰਡੀਗੜ੍ਹ ਪਹੁੰਚਣਾ ਅਤੇ ਇਹ ਮੇਰੇ ਲਈ ਬਹੁਤ ਜ਼ਰੂਰੀ ਹੈਗਾ ਏ ਆ ਜੇ ਮੈਂ ਦੇਰ ਨਾਲ ਪਹੁੰਚੀ ਤਾਂ ਮੇਰੀ ਫਲਾਈਟ ਮਿਸ ਹੋ ਜਾਣੀ ਹੈਗੀ ਆ ਅਤੇ ਕਿਰਪਾ ਕਰਕੇ ਮੈਨੂੰ ਛੇਤੀ ਤੋਂ ਛੇਤੀ ਕਨੈਕਟ ਕਰੋ ਧੰਨਵਾਦ